ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਮੈਨੂੰ ਆਪਣੀ ਬਾਡੀ ਨਾਲ ਬਹੁਤ ਪਿਆਰ ਹੈ ਅਤੇ ਮੈਂ ਆਪਣੀ ਬਾਡੀ ਨੂੰ ਅ ਆਲਵੇਜ਼ ਫਿੱਟ ਰੱਖਣ ਦੇ ਲਈ ਹਮੇਸ਼ਾ ਮੈਂ ਐਕਸਰਸਾਈਜ ਕਰਦਾ ਰਹਿੰਦਾ ਹੈਗਾ ਅਤੇ ਮੈਂ ਰੋਟਾ ਰੋਜ਼ਾਨਾ ਆਪਣੀ ਡੇਲੀ ਦੀ ਲਾਈਫ ਵਿੱਚ ਰੋਜ਼ਾਨਾ ਰਨਿੰਗ ਕਰਨ ਲਈ ਜਾਂਦਾ ਹਾਂ ਜੇ ਦੇਖਿਆ ਜਾਵੇ ਤਾਂ ਰਨਿੰਗ ਦੇ ਸਾਡੇ ਸਰੀਰ ਦੇ ਲਈ ਸਾਡੀ ਬਾਡੀ ਲਈ ਬਹੁਤ ਬੈਨੀਫਿਟ ਨੇ ਜਿਵੇਂ ਕਿ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਸਭ ਤੋਂ ਪਹਿਲਾਂ ਮੈਂ ਸੁਬਾਹ ਜਦੋਂ ਰਨਿੰਗ ਲਈ ਜਾਂਦਾ ਹਾਂ ਗਰਾਉਂਡ 'ਚ ਤਾਂ ਗਰਾਊਂਡ ਵਿੱਚ ਜਾਣ ਦੇ ਉਪਰੰਤ ਮੈਂ ਸਭ ਤੋਂ ਪਹਿਲਾਂ ਆਪਣੇ ਸਰੀਰ ਦਾ ਆਪਣੇ ਸਰੀਰ ਦਾ ਇਹਨੂੰ ਥੋੜ੍ਹਾ ਜਿਹਾ ਆਪਾਂ ਕਹਿ ਲਈਏ ਵੀ ਗਰਮ ਕਰਨ ਦੇ ਲਈ ਸਰੀਰ ਨੂੰ ਮੈਂ ਵਰਕੋ ਆਊਟ ਕਰਦਾ ਹੈਗਾ ਜਿਵੇਂ ਕਿ ਪਹਿਲਾਂ ਮੰਨ ਲਓ ਉੱਪਰ ਛਾਲ ਲਗਾਉਣੀ ਆ ਸਰੀਰ ਦੀ ਸਟਿਚਿੰਗ ਕਰਨੀ ਅਤੇ ਹਲਕਾ ਹਲਕਾ ਸਟੈਪ ਦੌੜਨਾ ਇਸ ਪ੍ਰਕਾਰ ਮੈਂ ਆਪਣੇ ਸਰੀਰ ਨੂੰ ਥੋੜ੍ਹਾ ਜਿਹਾ ਗਰਮ ਕਰ ਲੈਂਦਾ ਹੈਗਾ ਤਾਂ ਕਿ ਮੈਨੂੰ ਦੌੜਨ ਦੇ ਸਮੇਂ ਕੋਈ ਵੀ ਕਠਿਨਾਈ ਨਾ ਆਵੇ ਜਾਂ ਦੌੜਨ ਦੇ ਸਮੇਂ ਮੇਰਾ ਜਦੋਂ ਸਰੀਰ ਹੈ ਮੇਰੀ ਬਾਡੀ ਹੈ ਉਹ ਠੰਢੀ ਨਾ ਰਹੇ ਤਾਂ ਉਹ ਕੀ ਅਗਰ ਆਪਾਂ ਦੌੜਦੇ ਹਾਂ ਅਗਰ ਆਪਣਾ ਸਰੀਰ ਪ੍ਰੋਪਰ ਤਰੀਕੇ ਦੇ ਨਾਲ ਗਰਮ ਨਾ ਹੋਵੇ ਤਾਂ ਆਪਣੇ ਕਈ ਵਾਰ ਸੱਟ ਲੱਗਣ ਦਾ ਡਰ ਰਹਿੰਦਾ ਹੈ ਇਸ ਲਈ ਮੈਂ ਹਮੇਸ਼ਾ ਹੀ ਵਰਕ ਆਊਟ ਪਹਿਲਾਂ ਰਨਿੰਗ ਤੋਂ ਪਹਿਲਾਂ ਕਰਦਾ ਹਾਂ ਅਤੇ ਮੈਂ ਹਮੇਸ਼ਾ ਹੀ ਰਨਿੰਗ ਕਰਦਾ ਇਹਦੇ ਨਾਲ ਮੇਰੇ ਸਰੀਰ ਨੂੰ ਬਹੁਤ ਬੈਨੀਫਿਟ ਮਿਲਦਾ ਹੈਗਾ ਮੈਂ ਰੋਜ਼ਾਨਾ ਮੇਰੀ ਜ਼ਿੰਦਗੀ ਵਿੱਚ ਮੈਂ ਰਨਿੰਗ ਕਰਦਾ ਅਤੇ ਜਿਹਦੇ ਨਾਲ ਮੈਨੂੰ ਬਹੁਤ ਜ਼ਿਆਦਾ ਬੈਨੀਫਿਟ ਮਿਲ ਰਿਹਾ ਹੈਗਾ ਪਹਿਲਾਂ ਮੈਂ ਰਨਿੰਗ ਨਹੀਂ ਕਰਦਾ ਸੀ ਤਾਂ ਮੈਨੂੰ ਅ ਆਲਵੇਜ਼ ਹੀ ਹਮੇਸ਼ਾ ਮੰਨ ਲਓ ਸੁਬਹਾ ਮੈਂ ਉੱਠਦਾ ਤਾਂ ਮੈਨੂੰ ਇੱਕ ਤਰ੍ਹਾਂ ਦੀ ਮੇਰੇ ਸਰੀਰ 'ਚ ਆਲਸ ਜਿਹੀ ਪੈਦਾ ਹੋ ਗਈ ਸੀ ਵੀਕਨੈਸ ਜਿਹੀ ਮੈਨੂੰ ਲੱਗ ਰਹੀ ਸੀ ਮੇਰੇ ਸਰੀਰ 'ਚ ਪ੍ਰੋਪਰ ਮੈਨੂੰ ਕੋਈ ਚੰਗਾ ਮੈਨੂੰ ਕੋਈ ਕੰਮ ਮਤਲਬ ਹਾਲੇ ਕੋਈ ਵੀ ਮੈਂ ਕੰਮ ਕਰਦਾ ਤਾਂ ਮੇਰਾ ਉਹਦੇ ਵਿੱਚ ਮਨ ਨਹੀਂ ਲੱਗਦਾ ਸੀ ਕਹਿਣ ਤੋਂ ਭਾਵ ਕੀ ਹੈ ਮਨ ਆਲਸੀ ਹੋ ਗਿਆ ਸੀ ਸਰੀਰ ਕਿਸੇ ਕੰਮ ਨੂੰ ਕਰਨ ਨੂੰ ਜੀਅ ਨਹੀਂ ਕਰਦਾ ਸੀ ਪਰ ਜਦੋਂ ਤੋਂ ਮੈਂ ਰਨਿੰਗ ਕਰਨੀ ਸ਼ੁਰੂ ਕੀਤੀ ਹੈ ਤਾਂ ਉਦੋਂ ਤੋਂ ਮੇਰਾ ਸਰੀਰ ਐਂ ਇਕਦਮ ਫਿਟਨੈਸ ਜਿਹੜੀ ਹੈਗੀ ਐ ਪੂਰੀ ਪ੍ਰੋਪਰ ਰਹੀ ਹੈ ਅਤੇ ਮੇਰਾ ਹਰ ਇੱਕ ਮਨ ਕੰਮ 'ਚ ਮੇਰਾ ਮਨ ਪ੍ਰੋਪਰ ਲੱਗ ਰਿਹਾ ਹੈਗਾ ਅਤੇ ਮੈਂ ਹਰ ਇੱਕ ਕੰਮ ਨੂੰ ਪੂਰੇ ਚੇਤਨ ਮਨ ਦੇ ਨਾਲ ਦਿਮਾਗ ਦੇ ਨਾਲ ਪੂਰਾ ਕਹਿ ਦਈਏ ਪੂਰਾ ਇਕਾਗਰ ਹੋ ਕੇ ਮੈਂ ਇੱਕ ਚਿੱਤ ਹੋ ਕੇ ਮੈਂ ਕੰਮ ਕਰਦਾ ਹੈਗਾ ਅਤੇ ਦੌੜਨ ਦੇ ਨਾਲ ਮੇਰੇ ਸਰੀਰ ਵਿੱਚ ਬਹੁਤ ਜ਼ਿਆਦਾ ਕਹਿ ਦਈਏ ਆਪਾਂ ਫੁਰਤੀ ਵੀ ਆਈ ਹੈ ਅਤੇ ਮੇਰੇ ਸਰੀਰ ਨੂੰ ਦੌੜਨ ਦੇ ਨਾਲ ਮੇਰਾ ਸਰੀਰ ਅੱਗੇ ਨਾਲੋਂ ਬਹੁਤ ਤੰਦਰੁਸਤ ਰਹਿੰਦਾ ਹੈਗਾ ਇਸ ਨਾਲ ਕੀ ਹੈ ਮੈਂ ਬਹੁਤ ਸਾਰੀਆਂ ਬਿਮਾਰੀਆਂ ਤੋਂ ਵੀ ਦੂਰ ਰਹਿੰਦਾ ਹੈਗਾ ਜਿਵੇਂ ਕਿ ਮੰਨ ਲਓ ਪੇਟ ਦੀ ਚਰਬੀ ਹੋ ਗਈ ਆਪਣਾ ਪੇਟ ਵਧਣ ਲੱਗ ਜਾਂਦਾ ਹੈਗਾ ਅਕਸਰ ਹੀ ਆਪਾਂ ਦੇਖਦੇ ਅੱਜ ਕੱਲ੍ਹ ਦੀ ਜਨਰੇਸ਼ਨ ਜਿਹੜੀ ਹੈਗੀ ਆ ਉਹ ਮੰਨ ਲਓ ਕਹਿਣ ਦਾ ਭਾਵ ਕੀ ਹੈ ਬਾਡੀ ਨੂੰ ਫਿੱਟਨੈਸ ਰੱਖਣ ਪੂਰਾ ਫਿੱਟ ਰੱਖਣ ਲਈ ਪ੍ਰੋਪਰ ਜ਼ੋਰ ਦੇ ਰਹੀ ਹੈ ਸੋ ਇਸ ਲਈ ਮੈਂ ਬਿਮਾਰੀਆਂ ਤੋਂ ਵੀ ਬਚ ਰਿਹਾ ਹਾਂ ਮੈਂ ਡੇਲੀ ਦੌੜਨ ਡੇਲੀ ਮੈਂ ਆਪਣੀ ਜ਼ਿੰਦਗੀ ਵਿੱਚ ਦੌੜਨ ਜਾਂਦਾ ਹੈਗਾ ਅਤੇ ਇਹ ਦੌੜਨ ਦੇ ਨਾਲ ਮੇਰੀ ਜ਼ਿੰਦਗੀ ਵਿੱਚ ਬਹੁਤ ਜ਼ਿਆਦਾ ਬਦਲਾਵ ਵੀ ਆਇਆ ਹੈਗਾ ਅਤੇ ਇਸ ਦੌੜਨ ਦੇ ਨਾਲ ਰਨਿੰਗ ਕਰਨ ਦੇ ਨਾਲ ਮੈਂ ਅ ਆਲਵੇਜ਼ ਹਮੇਸ਼ਾ ਤੰਦਰੁਸਤ ਵੀ ਰਿਹਾ ਬਿਮਾਰੀਆਂ ਤੋਂ ਬਹੁਤ ਦੂਰ ਰਿਹਾ ਹੈਗਾ ਜਦੋਂ ਤੋਂ ਮੈਂ ਦੇਖਿਆ ਹੈਗਾ ਵੀ ਮੈਂ ਰਨਿੰਗ ਕਰਨੀ ਸ਼ੁਰੂ ਕੀਤੀ ਆ ਉਦੋਂ ਤੋਂ ਮੈਂ ਕਈ ਪ੍ਰਕਾਰ ਦੀ ਬਿਮਾਰੀ ਜਿਵੇਂ ਕਿ ਆਪਾਂ ਕਹਿ ਦਿੰਦੇ ਹਾਂ ਹੱਡ ਪੈਰ ਦੁਖਣੇ ਜਾਂ ਕਮਜ਼ੋਰੀ ਪੈਣੀ ਆਲਸ ਪੈਣੀ ਨੀਂਦ ਦਾ ਪ੍ਰੋਪਰ ਨਾ ਆਉਣਾ ਪਹਿਲਾਂ ਇੱਦਾਂ ਦੀਆਂ ਬਿਮਾਰੀਆਂ ਸੀ ਬਟ ਹੁਣ ਕੀ ਆ ਜਦੋਂ ਦਾ ਮੈਂ ਰਨਿੰਗ ਕਰਨ ਲੱਗਿਆ ਦੌੜਨ ਲੱਗਿਆ ਤਾਂ ਮੇਰਾ ਸਰੀਰ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਤੰਦਰੁਸਤ ਹੈ ਅਤੇ ਇਹਦੇ ਵਿੱਚ ਮੇਰੇ ਸਰੀਰ ਮੇਰੀ ਰਨਿੰਗ ਨੇ ਮੇਰੇ ਸਰੀਰ ਨੂੰ ਤੰਦਰੁਸਤ ਰਹਿਣ ਦੇ ਵਿੱਚ ਬਹੁਤ ਸਾਰਾ ਜਿਹੜਾ ਹੈਗਾ ਯੋਗਦਾਨ ਪਾਇਆ ਹੈਗਾ ਮੈਂ ਆਖਿਰ ਵਿੱਚ ਇਹੀ ਕਹਿਣਾ ਚਾਹੁੰਦਾ ਹੈਗਾ ਕਿ ਆਪਣੇ ਸਰੀਰ ਦੀ ਆਪਣੀ ਬਾਡੀ ਦਾ ਅ ਖਿਆਲ ਸਾਨੂੰ ਰੱਖਣਾ ਚਾਹੀਦਾ ਹੈਗਾ ਇਹਦੇ ਲਈ ਸਾਨੂੰ ਡੇਲੀ ਰੋਜ਼ਾਨਾ ਸਾਨੂੰ ਦੌੜਨਾ ਚਾਹੀਦਾ ਹੈਗਾ ਰਨਿੰਗ ਸਾਨੂੰ ਕਰਨੀ ਚਾਹੀਦੀ ਹੈ ਜੋ ਕਿ ਸਾਡੇ ਸਰੀਰ ਨੂੰ ਹਮੇਸ਼ਾ ਤੰਦਰੁਸਤ ਰੱਖਦੀ ਹੈ ਜਿਹੜਾ ਸਾਡਾ ਆਲਸਪੁਣਾ ਹੁੰਦਾ ਉਹਨੂੰ ਦੂਰ ਕਰਦੀ ਹੈ ਅਤੇ ਸਾਡਾ ਮਨ ਚੰਗੇ ਪਾਸੇ ਪੋਜ਼ਟਿਵਿਟੀ ਵੱਲ ਸਾਨੂੰ ਲੈ ਕੇ ਆਉਂਦਾ ਹੈ ਇਸ ਲਈ ਸਾਨੂੰ ਸਾਡੀ ਜ਼ਿੰਦਗੀ ਦੇ ਵਿੱਚ ਜਿਹੜੀ ਹੈਗੀ ਆ ਰੋਜ਼ਾਨਾ ਵਰਕ ਆਊਟ ਕਰਨਾ ਚਾਹੀਦਾ ਐਕਸਰਸਾਈਜ਼ ਸਾਨੂੰ ਕਰਨੀ ਚਾਹੀਦੀ ਹੈ ਇਸ ਨਾਲ ਸਾਡਾ ਜਿਹੜਾ ਸ ਰੀਰ ਆ ਉਹ ਵੀ ਪ੍ਰੋਪਰ ਤਰੀਕੇ ਦੇ ਨਾਲ ਫਿਟਨੈਸ ਵੀ ਪੂਰੀ ਰਹਿੰਦੀ ਹੈ